ਪੰਜਾਬ ਵਿੱਚ ਕੁਝ ਸਿੱਖਿਆ ਸੰਸਥਾਵਾਂ ਦੀ ਗੁਣਵੱਤਾ ਬੜੇ ਮਾੜੇ ਪੱਧਰ ਦੀ ਹੈ ਬੜੇ ਨੀਚਲੇ ਪੱਧਰ ਦੀ ਹੈ ਪ ਪੰਜਾਬ ਦੇ ਵਿੱਚ ਉੱਚ ਸਿੱਖਿਆ ਨੂੰ ਜਿੰਨੀ ਤਰਜੀਹ ਦੇਣੀ ਬਣਦੀ ਸੀ ਉੱਨੀ ਨਹੀਂ ਦਿੱਤੀ ਜਾ ਰਹੀ ਚਾਹੇ ਪੰਜਾਬ ਵੱਲੋਂ ਜਾਂ ਪੰਜਾਬ ਸਰਕਾਰ ਵੱਲੋਂ ਬਹੁਤ ਸਾਰੇ ਨਵੇਂ ਕਾਲਜਾਂ ਦੀ ਉਸਾਰੀ ਕੀਤੀ ਗਈ ਨਵੇਂ ਕਾਲਜ ਖੋਲ੍ਹ ਦਿੱਤੇ ਗਏ ਪਰ ਉਹ ਜਾਂ ਕਾਲਜਾਂ ਉਹ ਜਾਂ ਤਾਂ ਪਹਿਲਾਂ ਤੋਂ ਹੀ ਵਿਰਾਨ ਪਾਈਆਂ ਸਰਕਾਰੀ ਸੰਸ ਸੰਸਥਾਨਾਂ ਵਿੱਚ ਖੋਲ੍ਹੇ ਗਏ ਪਰ ਉਹਨਾਂ ਦਾ ਇੰਨਾਂ ਮਾੜਾ ਹਾਲ ਹੈ ਕਿ ਕਿਸੇ ਵੀ ਕਾਲਜ ਦੇ ਵਿੱਚ ਪ੍ਰੋਫੈਸਰ ਆ ਜਿਹੜੇ ਪੱਕੇ ਭਰਤੀ ਨਹੀਂ ਕੀਤੇ ਗਏ ਅਤੇ ਪੰਜਾਬ ਦੇ ਵਿੱਚ ਚੱਲ ਰਹੇ ਸਰਕਾਰੀ ਕਾਲਜਾਂ ਦੇ ਵਿੱਚ ਵੀ ਤੁਸੀਂ ਆਪ ਦੇਖੋਗੇ ਕਿ ਬਹੁਤ ਘੱਟ ਢਾਈ ਸੌ ਦੇ ਕਰੀਬ ਪੂਰੇ ਕਾਲਜਾਂ ਦੇ ਵਿੱਚ ਪੱਕੇ ਪ੍ਰੋਫੈਸਰ ਹਨ ਬਾਕੀ ਸਾਰੇ ਦੇ ਸਾਰੇ ਪ੍ਰੋਫੈਸਰ ਉਹ ਗੈਸਟ ਫੈਕਲਟੀ ਦੇ ਰੱਖੇ ਜਾ ਰਹੇ ਹਨ ਗੈਸਟ ਫੈਕਲਟੀ ਦੇ ਹੋਣ ਦੇ ਕਰਕੇ ਨਾ ਤਾਂ ਉਹਨਾਂ ਨੂੰ ਪੂਰਾ ਵੇਤਨ ਮਿਲਦਾ ਨਾ ਰੁਜ਼ਗਾਰ ਦੀ ਗਰੰਟੀ ਹੈ ਸੋ ਉਹ ਗੁਣਵੱਤਾ ਪੱਖੋਂ ਬੜੇ ਨੀਵੇਂ ਪੱਧਰ 'ਤੇ ਜਾ ਰਹੇ ਹਨ ਅਤੇ ਇਹਨਾਂ ਨੂੰ ਸੁਧਾਰਨ ਲਈ ਪੰਜਾਬ ਸਰਕਾਰ ਵੱਲੋਂ ਹਾਲੇ ਤੱਕ ਕੋਈ ਤਰਜੀਹ ਨਹੀਂ ਦਿੱਤੀ ਜਾ ਰਹੀ ਨਾ ਕੋਈ ਕਦਮ ਚੁੱਕੇ ਜਾ ਰਹੇ ਹਨ ਅਤੇ ਇਹਨਾਂ ਨੂੰ ਸੁਧਾਰਨ ਦੇ ਲਈ ਹੁਣ ਪੋਸਟਾਂ ਕੱਢਣਾ ਬਹੁਤ ਜ਼ਰੂਰੀ ਹੈ ਉਹਨਾਂ ਦੇ ਵਿੱਚ ਲੈਕਚਰਾਰ ਪ੍ਰੋਫੈਸਰ ਭਰਤੀ ਕਰਨਾ ਬਹੁਤ ਜ਼ਰੂਰੀ ਹੈ ਜਿਹਨੂੰ ਪੰਜਾਬ ਸਰਕਾਰ ਵੱਲੋਂ ਪਿਛਲੇ ਸਮੇਂ ਦੇ ਵਿੱਚ ਗਿਆਰ੍ਹਾਂ ਸੌ ਅਠਵੰਜਾ ਭਰਤੀ ਕੱਢੀ ਗਈ ਪਰ ਉਹ ਕਿਸੇ ਕਾਰਨ ਨੋਟੀਫਿਕੇਸ਼ਨ ਗਲਤ ਹੋਣ ਕਰਕੇ ਕੋਰਟ ਦੇ ਰਾਹੀਂ ਰੱਦ ਕਰ ਦਿੱਤੀ ਗਈ ਆ ਹੁਣ ਵੀ ਉਸ ਭਰਤੀ ਦੇ ਵਿੱਚ ਜਿਹੜੇ ਨੌਜਵਾਨ ਰਹਿ ਗਏ ਸਨ ਉਹ ਲਗਾਤਾਰ ਸਿੱਖਿਆ ਪ੍ਰਾਪਤ ਕਰਨ ਲਈ ਰੁਜ਼ਗਾਰ ਪ੍ਰਾਪਤ ਕਰਨ ਲਈ ਕਾਲਜਾਂ ਦੀ ਉੱਚ ਸਿੱਖਿਆ ਨੂੰ ਸੁਧਾਰਨ ਲਈ ਯੂਨੀਵਰਸਿਟੀਆਂ ਦੇ ਸਧਾਰਨ ਲਈ ਲਗਾਤਾਰ ਯਤਨਸ਼ੀਲ ਹਨ ਅਤੇ ਪੰਜਾਬ ਸਰਕਾਰ ਨੂੰ ਵੀ ਚਾਹੀਦਾ ਕਿ ਉਹ ਇਹਨਾਂ ਦੇ ਵਿੱਚ ਪੱਕੀ ਭਰਤੀ ਕਰੇ ਅਤੇ ਪੰਜਾਬ ਦੇ ਵਿੱਚ ਉੱਚ ਸਿੱਖਿਆ ਦੀ ਜਿਹੜੀ ਗੁਣਵੱਤਾ ਉਹਨੂੰ ਸੁਧਾਰੇ